ਹਾਂ ਭੰਗੜੇ ਦੇ ਪ੍ਰਦਰਸ਼ਨ ਲਈ ਆਮ ਕਰਕੇ ਪੰਜਾਬ ਦੇ ਵਿੱਚ ਤੁਰਲੇ ਵਾਲੀ ਪਗੜੀ ਸਜਾਈ ਜਾਂਦੀ ਹੈ ਅਤੇ ਚਾਦਰਾ ਅਤੇ ਕੁੜਤਾ ਜੋ ਪੰਜਾਬੀ ਭੰਗੜੇ ਦੇ ਵਿੱਚ ਆਮ ਪਸੰਦ ਕੀਤਾ ਜਾਂਦਾ ਹੈ ਸੋ ਨੌਜਵਾਨ ਪਾ ਪਗੜੀ ਸਜਾ ਕੇ ਅਤੇ ਚਾਦਰੇ ਬੰਨ ਕੇ ਅਤੇ ਕੁੜਤੇ ਪਾ ਕੇ ਅਤੇ ਨਾਲ ਸੰਮਾਂ ਵਾਲੀਆਂ ਡੰਗ ਡਾਂਗਾਂ ਫੜ੍ਹ ਕੇ ਅਤੇ ਬੜੇ ਤਰੀਕੇ ਦੇ ਨਾਲ ਉਹ ਭੰਗੜੇ ਪਾਉਂਦੇ ਹਨ ਅਤੇ ਲੋਕ ਉਹਨਾਂ ਨੂੰ ਪਸੰਦ ਕਰਦੇ ਹਨ ਸੋ ਇਸ ਦੇ ਅਨੁਸਾਰ ਡਾਂਸ ਕਰਨ ਵਾਲੇ ਇਹਨਾਂ ਤੋਂ ਵੱਖਰੇ ਹਨ ਅਤੇ ਪੰਜਾਬੀ ਭੰਗੜਾ ਡਾਂਸ ਦੇ ਨਾਲ ਕੋਈ ਮੈਚ ਨਹੀਂ ਕਰਦਾ ਇਹ ਪੰਜਾਬੀ ਸਾਡੀ ਅਦੁੱਤੀ ਭੰਗੜੇ ਦੀ ਟੀਮ ਜੋ ਹੈ ਉਹ ਅ ਬਹੁਤ ਵਧੀਆ ਸਰਦਾਰੀ ਟੈਪ ਦੇ ਨਾਲ ਭੰਗੜਾ ਪਾਉਂਦੇ ਹਨ